ਹੈਲੋ ਹਾਂਜੀ ਨੰਦ ਰਾਮ ਜੀ ਬੋਲਦੇ ਹੋ ਹੋਰ ਨੰਦ ਰਾਮ ਜੀ ਕੀ ਹਾਲ ਚਾਲ ਹੈ ਨੰਦ ਰਾਮ ਜੀ ਮੈਂ ਜੋਏ ਟੀ ਵੀ ਤੋਂ ਬੋਲ ਰਿਹਾ ਤੁਹਾਡੇ ਤੁਹਾਡੇ ਮਿੱਤਰ ਨੇ ਜਗਤਾਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਹੋਈ ਸੀ ਅਸਲ ਵਿੱਚ ਮੈਂ ਤੁਹਾਡੇ ਸ਼ਹਿਰ ਵਿੱਚ ਹੋਣ ਵਾਲੇ ਵੱਖ ਵੱਖ ਤਿਉਹਾਰਾਂ ਅਤੇ ਜੋ ਫੇਸਟੀਵਾਲ ਮਨਾਏ ਜਾਂਦੇ ਨੇ ਉਸ ਸੰਬੰਧੀ ਕੁਛ ਜਾਣਕਾਰੀ ਚਾਹੁੰਦਾ ਸੀ ਕੀ ਇਹ ਉਚਿਤ ਸਮਾਂ ਜੀ ਤੁਹਾਡੇ ਨਾਲ ਗੱਲ ਕਰਨ ਦਾ ਨੰਦ ਰਾਮ ਜੀ ਤੁਸੀਂ ਜਿਹੜੇ ਸ਼ਹਿਰ 'ਚ ਰਹਿੰਦੇ ਹੋ ਇਹ ਦੀ ਕਿੰਨੀ ਕੁ ਆਬਾਦੀ ਹੋਊਗੀ ਚੰਗੀ ਆਬਾਦੀ ਵਧੀਆ ਸ਼ਹਿਰ ਹੈ ਜੀ ਠੀਕ ਹੈ ਨੰਦ ਰਾਮ ਜੀ ਫਿਰ ਕਿਸ ਤਰ੍ਹਾਂ ਦੇ ਤਿਉਹਾਰ ਹੈ ਜਿਹੜੇ ਏਥੇ ਸਮੇਂ ਸਮੇਂ 'ਤੇ ਮਨਾਏ ਜਾਂਦੇ ਆ ਤੁਸੀਂ ਮੈਨੂੰ ਜੇ ਦੋ ਚਾਰ ਬਾਰੇ ਮੁੱਖ ਤਿਉਹਾਰਾਂ ਬਾਰੇ ਜਾਣਕਾਰੀ ਦੇ ਸਕੋ

ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਸਰ ਇਲਾਕੇ ਦੇ ਦੂਰੋਂ ਬਾਹਰਲੇ ਇਲਾਕਿਆਂ ਤੋਂ ਵੀ ਲੋਕਾਂ ਦੇ ਹੋਣਗੇ ਜੀ

ਠੀਕ ਹੈ ਜੀ ਇੱਕ ਤਾਂ ਇਹ ਹੋ ਗਿਆ ਜੀ ਹੋਰ ਇਸ ਤੋਂ ਬਿਨਾਂ ਕੋਈ ਵੱਡਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ

ਝਾਕੀਆਂ ਵੀ ਲਾਉਂਦੇ ਹੋਣੇ ਜੀ ਠੀਕ ਹੈ ਠੀਕ ਹੈ ਠੀਕ ਹੈ

ਇਹ ਤੁਹਾਡੇ ਇਲਾਕੇ ਦਾ ਕੋਈ ਖਾਸ ਜਿਹੜਾ ਧਾਰਮਿਕ ਜਾਂ ਕੋਈ ਇਤਿਹਾਸਕ ਕੋਈ ਮੇਲਾ ਲਗਾਇਆ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜਿਸ ਦਿਨ ਜਿਸ ਦਿਨ ਵੀ ਕੋਈ ਤਿਉਹਾਰ ਬਣਦਾ ਹੈ ਤਾਂ ਬੜੀ ਖੁਸ਼ੀ ਨਾਲ ਅਤੇ ਧੂਮ ਧਾਮ ਨਾਲ ਲੋਕ ਸਾਰੀਆਂ ਚੀਜ਼ਾਂ ਜਿਹੜੇ ਰਲ ਮਿਲ ਕੇ ਮਨਾਉਂਦੇ ਬਹੁਤ ਬਹੁਤ ਵਧੀਆ ਨਹੀਂ ਚੰਗੀ ਗੱਲ ਹੈ ਨੰਦ ਰਾਮ ਜੀ ਬਹੁਤ ਬਹੁਤ ਤੁਹਾਡੇ ਨਾਲ ਗੱਲ ਕਰਕੇ ਬਹੁਤ ਖ਼ੁਸ਼ੀ ਹੋਈ ਬੜੀ ਜਾਣਕਾਰੀ ਮਿਲੀ ਭਰਪੂਰ ਤੁਹਾਡਾ ਚੈਨਲ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਓਕ ਓਕੇ ਸਰ ਓਕੇ ਜੀ